ਪੰਜਾਬ ਦੇ ਲੋਕ ਆਪਣੀ ਪਛਾਣ ਦੇ ਸਬੰਧੀ ਦੀ ਭਾਸ਼ਾ ਨੂੰ ਪ੍ਰਗਟ ਕਰਨ ਲਈ ਆਪਣੀ ਭਾਸ਼ਾ ਇੱਕ ਤਾਂ ਪਿਓਰ ਪੰਜਾਬੀ ਬੋਲਦੇ ਨੇ ਪੰਜਾਬੀ ਗਾਣੇ ਸੁਣਦੇ ਨੇ ਅਤੇ ਸ਼ੋਪਸ ਦੇ ਉੱਤੇ ਜਿਹੜੀ ਵੀ ਸ਼ੋਪਸ ਜਿਸ ਚੀਜ਼ ਦੀ ਆ ਉਹਦੇ ਨਾਂ ਵੀ ਪੰਜਾਬੀ 'ਚ ਲਿਖਿਆ ਹੁੰਦਾ ਅਤੇ ਬੱਸਾਂ ਉੱਤੇ ਜਾਉਣ ਆਉਣ ਦੇ ਰੂਟ ਪੰਜਾਬੀ 'ਚ ਲਿਖੇ ਹੁੰਦੇ ਹਨ ਅਤੇ ਹਾਊਸ ਨੰਬਰ ਬਾਹਰ ਵੀ ਪੰਜਾਬੀ 'ਚ ਨਾਮ ਲਿਖਿਆ ਹੁੰਦਾ ਘਰ ਦੇ ਬਾਹਰ ਅਤੇ ਕਿਸੇ ਨੂੰ ਕਿਸੇ ਰੂਟ ਦਾ ਰਸਤਾ ਪੁੱਛਣਾ ਕਿਤੇ ਜਾਣ ਦਾ ਰਸਤਾ ਪੁੱਛਣਾ ਉਹ ਪੰਜਾਬੀ 'ਚ ਪੁੱਛਦੇ ਨੇ ਅਤੇ ਪੰਜਾਬੀ ਭਾਸ਼ਾ ਹੁਣ ਇੰਨੀ ਵਧੀਆ ਹੋ ਚੁੱਕੀ ਹੈ ਕਿ ਹਿੰਦੀ ਤੋਂ ਦੂਜੇ ਨੰਬਰ 'ਤੇ ਪੰਜਾਬੀ ਦਾ ਨਾਂ ਆਉਂਦਾ ਅਤੇ ਪੂਰੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਪੰਜਾਬੀ ਭਾਸ਼ਾ ਦੇ ਗਾਣੇ ਸੁਣੇ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਵੀ ਪੂਰੇ ਵਰਲਡ ਦੇ ਵਿੱਚ ਵੀ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਹਨ ਉੱਥੇ ਪੰਜਾਬੀ ਗਾਣੇ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਅਤੇ ਪੰਜਾਬੀ ਦੇ ਵਿੱਚ ਹੀ ਗੱਲਬਾਤ ਕੀਤੀ ਜਾਂਦੀ ਹੈ ਇਸ ਤਰ੍ਹਾਂ ਉਹ ਆਪਣੀ ਭਾਸ਼ਾ ਦਾ ਪ੍ਰਗਟਾਵਾ ਕਰਦੇ ਹਨ ਅਤੇ ਪੰਜਾਬੀ ਭਾਸ਼ਾ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਨਾਲ ਬੋਲੀ ਜਾਂਦੀ ਹੈ ਅਤੇ ਪੰਜਾਬੀ ਭਾਸ਼ਾ ਦਾ ਹੁਣ ਬਹੁਤ ਜ਼ਿਆਦਾ ਵਿਸਥਾਰ ਹੋ ਚੁੱਕਿਆ ਆਪਾਂ ਇੰਡੀਆ ਦੇ ਵਿੱਚ ਤੋਂ ਇ ਇੰਡੀਆ ਦੇ ਵਿੱਚ ਇੰਡੀਆ ਤੋਂ ਇਲਾਵਾ ਕਿਤੇ ਵੀ ਜਾਂਦੇ ਹਾਂ ਜਿੱਥੇ ਆਪਾਂ ਨੂੰ ਪੰਜਾਬੀ ਮਿਲਦੇ ਹਨ ਉਹ ਪੰਜਾਬੀ ਵਿੱਚ ਹੀ ਗੱਲ ਕਰਦੇ ਹਨ ਅਤੇ ਅਖ਼ਬਾਰਾਂ ਪੰਜਾਬੀ 'ਚ ਆਉਂਦੀਆਂ ਹਨ ਚੈਨਲ ਹਨ ਬਹੁਤ ਚੈਨਲ ਹਨ ਜਿਹੜੇ ਪੰਜਾਬੀ ਹਨ ਅਤੇ ਪੰਜਾਬੀ ਗਾਣੇ ਚਲਦੇ ਹਨ ਉਹਨਾਂ ਦੇ ਵਿੱਚ ਇਸ ਤਰ੍ਹਾਂ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਵਿਸਥਾਰ ਹੋ ਚੁੱਕਿਆ ਅਤੇ ਪੰਜਾਬੀ ਭਾਸ਼ਾ ਨੂੰ ਬੋਲਣਾ ਅਤੇ ਇੱਥੋਂ ਦੇ ਲੋਕਾਂ ਦਾ ਮੇਨ ਬੋਲਣ ਦਾ ਵਿਚਾਰ ਕਰਨ ਦਾ ਤਰੀਕਾ ਸਾਰਾ ਪੰਜਾਬੀ ਵਿੱਚ ਹੀ ਹੈ ਇਸ ਤਰ੍ਹਾਂ ਨਾਲ ਸਾਰੇ ਏਰੀਆ ਦੇ ਵਿੱਚ ਅਲੱਗ ਅਲੱਗ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ ਉੱਥੇ ਜਿੱਥੇ ਪੰਜਾਬੀ ਰਹਿੰਦੇ ਹਨ ਤਾਂ ਉਹ ਪੰਜਾਬੀ ਵਿੱਚ ਹੀ ਬੋਲਦੇ ਹਨ ਪੰਜਾਬੀ ਵਿੱਚ ਹੀ ਗੱਲ ਕਰਦੇ ਹਨ ਅਤੇ ਇਸ ਤਰ੍ਹਾਂ ਪੰਜਾਬੀ ਭਾਸ਼ਾ ਦਾ ਪ੍ਰਗਟ ਕਰਨ ਦਾ ਭਾਸ਼ਾ ਸਬੰਧ ਕੀਤਾ ਜਾਂਦਾ ਹੈ